ਮੈਂ ਸਵੇਰੇ ਅਤੇ ਰਾਤ ਨੂੰ ਦੋ ਵਾਰੀ ਖਬਰਾਂ ਸੁਣਦੀ ਹਾਂ ਮੈਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਹੈ ਖੇਡਾਂ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਸਰੀਰ ਸਵਸਥ ਰਹਿੰਦਾ ਹੈ ਮਨੋਰੰਜਨ ਵੀ ਮੈਨੂੰ ਬਹੁਤ ਪਸੰਦ ਹੈ ਅਗਰ ਮਨ ਲਗਾਨਾ ਹੋਏ ਤਾਂ ਮਨੋਰੰਜਨ ਬਹੁਤ ਜ਼ਰੂਰੀ ਹੈ ਜਿਵੇਂ ਕਿ ਪਿਕਚਰ ਦੇਖ ਲਈ ਕੋਈ ਸੀਰੀਅਲ ਦੇਖਿਆ ਇਹਦੇ ਨਾਲ ਆਪਾਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਰਾਜਨੀਤੀ ਵਿੱਚ ਵੀ ਮੈਨੂੰ ਬਹੁਤ ਦਿਲਚਸਪੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਦੇਸ਼ ਵਿੱਚ ਕੀ ਹੋ ਰਿਹਾ ਹੈ ਔਰ ਦੇਸ਼ ਆਪਣਾ ਕਿੰਨੀ ਕੁ ਤਰੱਕੀ ਵਿੱਚ ਜਾ ਰਿਹਾ ਹੈ ਇਹਦੇ ਬਿਨਾਂ ਵੀ ਜਦ ਤੱਕ ਆਪਾਂ ਨੂੰ ਰਾਜਨੀਤੀ ਬਾਰੇ ਪਤਾ ਨਹੀਂ ਚੱਲਦਾ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਣੇ ਮਿਨਿਸਟਰ ਪ੍ਰਾਈਮ ਮਿਨਿਸਟਰ ਹੋਮ ਮਿਨਿਸਟਰ ਕੌਣ ਹਨ ਅਤੇ ਉਹਨਾਂ ਉਹ ਕੀ ਕੀ ਕੰਮ ਕਰਦੇ ਹਨ ਉਨ੍ਹਾਂ ਨੂੰ ਕਿਹੜੀ ਜਿੰਮੇਵਾਰੀ ਦਿੱਤੀ ਹੋਈ ਹੈ